ਸਤਿ ਸ਼੍ਰੀ ਅਕਾਲ ਅਮਨ ਟੈਕਸੀ ਸਟੈਂਡ ਤੋਂ ਗੱਲ ਕਰ ਰਹੇ ਓਂ ਸਰ ਮੈਂ ਤੁਹਾਡੇ ਕੋਲੋਂ ਇੱਕ ਕੈਬ ਹੈ ਜਿਹੜੀ ਬੁੱਕ ਕੀਤੀ ਸੀਗੀ ਮੈਂ ਪਿਛਲੇ ਅੱਧੇ ਘੰਟੇ ਤੋਂ ਆਪਣੇ ਮੋਲ ਦੇ ਬਾਹਰ ਖੜੀ ਹੋ ਕੇ ਵੇਟ ਕਰ ਰਹੀ ਹਾਂ ਕਦੋਂ ਦੀ ਜਿਹੜੀ ਕੈਬ ਹੈ ਬੁਕਿੰਗ ਅਸੀਂ ਕਰਵਾ ਦਿੱਤੀ ਹੋਈ ਆ ਮੈਂ ਔਨਲਾਇਨ ਪੇਮੇਂਟ ਵੀ ਕਰ ਦਿੱਤੀ ਹੋਈ ਆ ਪਰ ਜਿਹੜੀ ਕੈਬ ਹੈ ਉਹ ਹਲੇ ਤੱਕ ਸਾਡੇ ਕੋਲ ਨਹੀਂ ਪੁਹੰਚੀ ਹੈ ਮੈਂ ਪਿਛਲੇ ਅੱਧੇ ਘੰਟੇ ਤੋਂ ਵੇਟ ਕਰ ਰਹੀ ਹਾਂ ਪਰ ਜਿਹੜੀ ਕੈਬ ਹੈ ਉਹ ਹਲੇ ਤੱਕ ਨਹੀਂ ਆ ਰਹੀ ਹੈ ਮੈਂ ਧੁੱਪ ਦੇ ਵਿੱਚ ਖੜੀ ਹਾਂ ਮੇਰੇ ਕੋਲ਼ ਕਿਉਂਕਿ ਮੈਂ ਸ਼ੋਪਿੰਗ ਕਰਕੇ ਨਿਕਲੀ ਹਾਂ ਤਾਂ ਮੇਰੇ ਕੋਲ਼ ਬਹੁਤ ਸਾਰਾ ਸਮਾਨ ਵੀ ਹੈ ਤਾਂ ਪਲੀਜ਼ ਤੁਸੀਂ ਮੈਨੂੰ ਦੱਸ ਦਿਓ ਇੰਨੀ ਜ਼ਿਆਦਾ ਦੇਰੀ ਆ ਕਿਉਂ ਹੋ ਰਹੀ ਆ ਤਾਂ ਕਿ ਅਗਰ ਤੁਹਾਨੂੰ ਹੋਰ ਵੀ ਜ਼ਿਆਦਾ ਟਾਇਮ ਲੱਗਣਾ ਤਾਂ ਅਸੀਂ ਆਪਣੀ ਕੈਬ ਕੈਂਸਲ ਕਰਕੇ ਤਾਂ ਕੋਈ ਹੋਰ ਕੈਬ ਕਰ ਲਈਏ